ਮੈਂ ਇੱਕ ਔਰਤ ਨੂੰ ਜਾਣਦੀ ਹਾਂ ਜਿਸ ਦਾ ਬਹੁਤ ਮੁਸ਼ਕਿਲ ਨਾਲ ਕੰਮ ਚੱਲਿਆ ਕੱਪੜੇ ਸਿਊਣ ਦਾ ਕੰਮ ਕਰਦੀ ਸੀ ਉਹ ਕਦੀ ਕਿਸੇ ਦੇ ਘਰ ਜਾ ਕੇ ਕਦੇ ਕਿਸੇ ਦੇ ਘਰ ਜਾ ਕੇ ਕੱਪੜੇ ਮੰਗਣੇ ਅਤੇ ਸੀਕੇ ਉਹਨਾਂ ਨੂੰ ਦੇਣੇ ਬਹੁਤ ਮਾਮੂਲੀ ਦਰ ਦੇ ਉੱਤੇ ਉਹਨੇ ਕੰਮ ਕਰ ਦੇਣਾ ਪਰ ਸਮਾਂ ਬੀਤਦਾ ਗਿਆ ਉਸਦਾ ਕੰਮ ਵਧੀਆ ਹੋਣਾ ਸ਼ੁਰੂ ਹੋ ਗਿਆ ਅੱਜ ਉਹ ਸਮਾਂ ਆ ਗਿਆ ਹੈ ਕਿ ਉਸ ਦੇ ਕੰਮ ਨੂੰ ਲੋਕ ਇੰਨਾ ਪਸੰਦ ਕਰਦੇ ਹਨ ਕਿ ਉਹਦੇ ਕੋਲ ਕਿਸੇ ਹੋਰ ਲਈ ਸਮਾਂ ਹੈ ਨਹੀਂ ਉਹਨੇ ਬਹੁਤ ਵੱਡੀ ਦੁਕਾਨ ਪਾ ਲਈ ਹੈ ਕੋਈ ਸਮਾਂ ਸੀ ਕਿ ਬੁਟੀਕਾਂ 'ਤੇ ਜਾ ਜਾ ਕੇ ਲੋਕਾਂ ਕੋਲੋ ਕੱਪੜੇ ਮੰਗਦੀ ਸੀ ਕਿ ਮੈਨੂੰ ਕੁਝ ਇੱਕ ਤੁਹਾਨੂੰ ਸੀਕੇ ਦਿੰਦੇ ਦਾ ਮੌਕਾ ਦਿੱਤਾ ਜਾਵੇ ਅੱਜ ਉਸਦੇ ਆਪਣੇ ਬੱਚਿਆਂ ਦੇ ਨਾਮ 'ਤੇ ਉਸਨੇ ਐਡੀ ਵੱਡੀ ਦੁਕਾਨ ਖੋਲ੍ਹੀ ਹੋਈ ਹੈ ਜਿਸ ਦੇ ਬਾਹਰ ਲਾਈਨਾਂ ਲੱਗੀਆਂ ਹੁੰਦੀਆਂ ਹਨ ਅਤੇ ਉਹ ਹਰ ਤਰੀਕੇ ਦਾ ਕੱਪੜਾ ਤੁਹਾਨੂੰ ਸੀਕੇ ਦੇ ਸਕਦੀ ਹੈ ਉਹ ਤੁਹਾਡੇ ਕਿਸੇ ਵੀ ਚੀਜ਼ 'ਤੇ ਤੁਸੀਂ ਕਹੋ ਮੇਰਾ ਕੱਪੜਾ ਖਰਾਬ ਹੋ ਰਿਹਾ ਉਹਨੂੰ ਇੰਨੀ ਕਲਾਕਾਰੀ ਦੇ ਨਾਲ ਸੀਕੇ ਦਿੰਦੀ ਹੈ ਕਿ ਤੁਹਾਡੀ ਸੋਚ ਤੋਂ ਪਰੇ ਇੱਕ ਨਵੀਂ ਜਿਹੀ ਚੀਜ਼ ਨਿਕਲ ਕੇ ਆਉਂਦੀ ਹੈ ਜਿਹਦੇ ਨਾਲ ਪਾ ਕੇ ਇਨਸਾਨ ਨੂੰ ਲੱਗਦਾ ਉਹਨੇ ਬਹੁਤ ਹੀ ਕਰਿਸ਼ਮਾ ਹੀ ਕਰ ਦਿੱਤਾ ਹੈ ਬਹੁਤ ਸੁੰਦਰਤਾ ਅਤੇ ਬਹੁਤ ਹੀ ਸਰਲਤਾ ਦੇ ਨਾਲ ਔਰ ਆਪਣੀ ਮੁਸਕਾਨ ਬਣਾਈ ਰੱਖੀ ਉਸ ਔਰਤ ਨੇ ਜਿਸ ਉਮਰ 'ਚ ਜਾ ਕੇ ਜੋ ਪਾਇਆ ਹੈ ਹੁਣ ਉਹਨੂੰ ਜਿਊਣ ਦੇ ਨਾਲ ਨਾਲ ਜਿਊਣਾ ਆ ਗਿਆ ਹੈ ਜਿਊਣ ਦੇ ਨਾਲ ਨਾਲ ਉਹ ਆਪਣਾ ਸਰ ਉੱਚਾ ਕਰਕੇ ਆਪਣੇ ਇਸ ਇਸ ਦੁਨੀਆ ਵਿੱਚ ਆਪਣਾ ਇਕ ਨਾਮ ਕਮਾ ਚੁੱਕੀ ਹੈ